ਦੇਖੋ ਕੋਈ ਵੀ ਸਰਕਾਰ ਹੁੰਦੀ ਹੈ ਉਹਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਉਹ ਅਤੇ ਜਿਹੜੇ ਗੁਆਂਡ ਦੇਸ਼ ਨੇ ਜਾਂ ਗੁਆਂਡ ਰਾਜ ਨੇ ਉਹਨਾਂ ਨੇ ਨਾਲ ਉਹਨਾਂ ਦੇ ਰਿਸ਼ਤੇ ਜਿਹੜੇ ਆ ਵਧੀਆ ਬਣੇ ਰਹਿਣ ਕੋਈ ਵੀ ਨਹੀਂ ਸਰਕਾਰ ਚਾਹਵੇਗੀ ਕਿ ਉਹਦੇ ਗੁਆਂਡੀਆਂ ਦੇ ਨਾਲ ਸਰਕਾਰ ਤੁਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰ ਲਓ ਸਰਕਾਰ ਵੀ ਤਾਂ ਇੱਦਾਂ ਹੀ ਅੱਗੇ ਚੱਲਦੀ ਹੈ ਅਸੀਂ ਕਿਆ ਚਾਹਵਾਂਗੇ ਕਿ ਮਤਲਵ ਸਾਡੇ ਗੁਆਂਡੀਆਂ ਨਾਲ ਰਿਸ਼ਤੇ ਨਾ ਹੋਣ ਵਧੀਆ ਔਖੇ ਵੇਲੇ ਅਲਟੀਮੇਟਲੀ ਸਾਡੇ ਗੁਆਂਡੀ ਹੀ ਸਾਡੇ ਕੰਮ ਆਉਂਦੇ ਹੈ ਉਸ ਤਰ੍ਹਾਂ ਸਰਕਾਰ ਵੀ ਹਮੇਸ਼ਾਂ ਚਾਹੁੰਦੀ ਹੈ ਕਿ ਉਹਨਾਂ ਦੇ ਗੁਆਂਡੀ ਦੇਸ਼ ਜਾ ਗੁਆਂਡੀ ਰਾਜ ਆ ਜਿਹੜੇ ਉਹਨਾਂ ਨਾਲ ਅੱਛੇ ਬਣੇ ਰਹਿਣ ਰ ਰਿਲੇਸ਼ਨ ਸੋ ਦੈਟ ਔਖੇ ਵੇਲੇ ਇੱਕ ਦੂਸਰੇ ਦੇ ਕੰਮ ਆ ਸਕੀਏ ਠੀਕ ਹੈ ਅਤੇ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ ਦੇਖੋ ਬਿਲਕੁਲ ਮੈਨੂੰ ਲੱਗਦਾ ਹੈ ਪਰਸਨਲ ਮੇਰੀ ਜਿਹੜੀ ਕੈਲਕੂਲੇਸ਼ਨ ਇਹ ਹੀ ਕਹਿੰਦੀ ਐ ਕਿ ਕੋਸ਼ਿਸ਼ ਕਰਦੇ ਨੇ ਉਹਨਾਂ 'ਚੋਂ ਇੱਕ ਇਗਜਾਮਪਲ ਹੈਗਾ ਆਪਣਾ ਜੇ ਲੈ ਲਈਏ ਸਟੂਡੈਂਟ ਐਕਸਚੇਂਜ ਪ੍ਰੋਗਰਾਮਸ ਜਿਹੜੇ ਚੱਲ ਰਹੇ ਨੇ ਯੂਨੀਵਰਸਿਟੀਸ ਦੇ ਵਿੱਚ ਹੁਣ ਉਹ ਅਲਟੀਮੇਟਲੀ ਕੀ ਹੈ ਸਟੂਡੈਂਟ ਐਕਸਚੇਂਜ ਲੱਗਦਾ ਕਿ ਹਾਂ ਯਾਰ ਦੂਜੇ ਦੇਸ਼ 'ਚ ਬੱਚੇ ਜਾ ਰਹੇ ਨਹੀਂ ਇਹ ਸਿਰਫ਼ ਬੱਚਿਆਂ ਨੂੰ ਉਧਰ ਅਸੀਂ ਭੇਜ ਨਹੀਂ ਰਹੇ ਅਸੀਂ ਬੱਚਿਆਂ ਨੂੰ ਮੌਕਾ ਦੇ ਰਹੇ ਹਾਂ ਦੂਜੀਆਂ ਸਰਕਾਰਾਂ ਵੀ ਸਾਡੇ ਬੱਚਿਆਂ ਨੂੰ ਮੌਕਾ ਦੇ ਰਹੀਆਂ ਆਓ ਸਮਝੋ ਕੁਛ ਨਵਾਂ ਸਿੱਖੋ ਜਾ ਕੇ ਆਪਣੇ ਦੇਸ਼ 'ਚ ਆਪਣੇ ਰਾਜਯ ਦੇ ਵਿੱਚ ਇੰਪਲੀਮੈਂਟ ਕਰੋ ਆਪਣੇ ਦੇਸ਼ ਦੀ ਆਪਣੇ ਰਾਸ਼ਟਰ ਦੀ ਆਪਣੇ ਸਟੇਟ ਦੀ ਤਰੱਕੀ ਕਰਵਾਉ ਹੁਣ ਮੰਨ ਲਓ ਮੈਂ ਇੱਦਾਂ ਹੀ ਲੈ ਲੈਣਾ ਕਿ ਚਲੋ ਪੰਜਾਬ ਸਰਕਾਰ ਮਨਾਂਹ ਕਰ ਦਿੰਦੀ ਹੈ ਜੀ ਸਾਡੀ ਸਟੇਟ ਦਾ ਕੋਈ ਵੀ ਬੱਚਾ ਬਾਹਰ ਨਹੀਂ ਜਾਵੇਗਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਨੂੰ ਲੈ ਕੇ ਕੀ ਹੋਵੇਗਾ ਬੱਚੇ ਬਾਹਰ ਜਾ ਰਹੇ ਨੇ ਕੈਨੇਡਾ ਇੰਨੇ ਜਾਣੇ ਬੱਚੇ ਜਾ ਰਹੇ ਅਮੇਰੀਕਾ ਯੂ ਕੇ ਪਰ ਵਾਪਸ ਨਹੀਂ ਆ ਰਹੇ ਬਟ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਬੱਚਾ ਜਾ ਕੇ ਵਾਪਸ ਆਉਂਦਾ ਜਦੋਂ ਇੱਥੇ ਆਉਂਦਾ ਹੈ ਅਖੇ ਕੀ ਹੁੰਦਾ ਉੱਥੇ ਜੋ ਵੀ ਕੁਛ ਨਵਾਂ ਸਿੱਖ ਕੇ ਆਇਆ ਹੁੰਦਾ ਬੱਚਾ ਇੱਥੇ ਇੰਪਲੀਮੈਂਟ ਕਰਦਾ ਜਦੋਂ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਜੋ ਓਵੀਅਸ ਜਿਹੀ ਗੱਲ ਹੈ ਜੀ ਅੱਜ ਜੇ ਮੇਰੇ ਦਸ 'ਚੋਂ ਨੌਂ ਨੰਬਰ ਆਉਂਦੇ ਪਏ ਨੇ ਮੈਂ ਨੰਬਰ ਦੀ ਗੱਲ ਇਸ ਕਰਕੇ ਕਰ ਰਿਹਾ ਟੀਚਰ ਹੈਗਾ ਕੀ ਓਵਰਆਲ ਕੰਮਕਾਰ ਦੀ ਗੱਲ ਕਰ ਰਿਹਾਂ ਕਿ ਦਸਾਂ 'ਚੋਂ ਨੌਂ ਨੰਬਰ ਮੈਨੂੰ ਮੰਨ ਲਓ ਮਿਲਦੇ ਪਏ ਨੇ ਉਹ ਸਿੱਖ ਕੇ ਮੈਂ ਜਦੋਂ ਇੰਪਲੀਮੈਂਟ ਕਰਾਂਗਾ ਹੋ ਸਕਦਾ ਨੌਂ ਪੁਆਇੰਟ ਇੱਕ ਹੋਣ ਦਸ ਬਟਾ ਦਸ ਹਜੇ ਵੀ ਨਾ ਹੋਣ ਪਰ ਉਹ ਨੌਂ ਪੁਆਇੰਟ ਇੱਕ ਦਾ ਮਤਲਬ ਵੱਧ ਰਾ ਹੀ ਹੋਇਆ ਕੁਛ ਉਹ ਸਾਰੀਆਂ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਸਰਕਾਰ ਆਪਣੇ ਲੈਵਲ 'ਤੇ ਕਰ ਰਹੀਆਂ ਬਾਕੀ ਦੂਸਰੇ ਦੇਸ਼ਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਵਧੀਆ ਰੱਖਣ ਲਈ